ਹੈਲੋ ਮੀਸ਼ੋ ਸਰਵਿਸ ਸੈਂਟਰ ਮੈਂ ਬੀਰਪਾਲ ਕੌਰ ਮੇਰਾ ਪਿੰਡ ਖਿਲਣ ਹੈ ਮੈਂ ਤੁਹਾਡੇ ਤੋਂ ਮੀਸ਼ੋ ਤੋਂ ਕੁਝ ਨਾ ਕੁਝ ਮੰਗਾਉਂਦੀ ਰਹਿੰਦੀ ਹਾਂ ਇਸ ਵਾਰ ਮੈਂ ਮੀਸ਼ੋ ਤੋਂ ਸ਼ਰਟਸ ਮੰਗਵਾਈਆਂ ਸੀ ਪਹਿਲਾਂ ਤਾਂ ਡਿਲੀਵਰੀ ਬੋਆਏ ਬਹੁਤ ਜ਼ਿਆਦਾ ਲੇਟ ਆਇਆ ਮੈਂ ਉਸਦੀ ਵੇਟ ਕਰੀ ਗਈ ਫਿਰ ਥੋੜ੍ਹੀ ਦੇਰ ਬਾਅਦ ਉਸ ਦਾ ਫੋਨ ਆਇਆ ਅਤੇ ਉਸਨੇ ਮੈਨੂੰ ਕਿਹਾ ਔਰ ਬਹੁਤ ਜ਼ਿਆਦਾ ਰੁੱਖਾ ਬੋਲਿਆ ਅਤੇ ਸ਼ਰਟਸ ਵੀ ਬਹੁਤ ਜ਼ਿਆਦਾ ਘਟੀਆ ਸੀ ਅਤੇ ਪੈਕਿੰਗ ਬਹੁਤ ਜ਼ਿਆਦਾ ਖਰਾਬ ਸੀਗੀ ਪੈਕਿੰਗ ਪੂਰੀ ਤਰ੍ਹਾ ਡੱਬਾ ਉਸਦਾ ਟੁੱਟਿਆ ਹੋਇਆ ਸੀਗਾ ਮਤਲਬ ਕਿ ਸ਼ਰਟਸ ਬਾਹਰ ਨਿਕਲ ਗਈਆਂ ਸੀ ਉਹਨਾਂ ਦਾ ਕਲਰ ਵੀ ਸੇਮ ਨਹੀਂ ਸੀਗਾ ਅਤੇ ਉਨ ਕੱਪੜਾ ਖਰਾਬ ਸੀ ਨਾ ਹੀ ਮੇਰੇ ਘਰਦਿਆਂ ਨੂੰ ਵਧੀਆ ਲੱਗਿਆ ਨਾ ਹੀ ਮੈਨੂੰ ਵਧੀਆ ਲੱਗਿਆ ਮੈਂ ਗਰਮੀ ਵਾਲੀਆਂ ਮੰਗਾਈਆਂ ਸੀ ਉਹਨਾਂ ਨੇ ਸਰਦੀ ਵਾਲੀਆਂ ਫੜਾ ਗਏ ਐ ਮੈਨੂੰ ਜਾਂ ਤਾਂ ਮੈਨੂੰ ਮੇਰੇ ਪੈਸੇ ਵਾਪਸ ਕੀਤੇ ਜਾਣ ਜਾਂ ਫਿਰ ਮੈਨੂੰ ਸ਼ਰਟਸ ਚੇਂਜ ਕਰਕੇ ਮੈਨੂੰ ਜੋ ਮੈਂ ਮੰਗਾਇਆ ਸੀ ਉਹ ਦਿੱਤੀਆਂ ਜਾਣ ਧੰਨਵਾਦ